ਮੋਹਾਲੀ ਜ਼ਿਲ੍ਹੇ ਵਿੱਚ ਮੁੱਖ ਜਿਹੜੇ ਉਦਯ ਸਰੋਤ ਹਨ ਉਦਯੋਗ ਹਨ ਉਹ ਸਵੈ ਰੁਜ਼ਗਾਰ ਦੀਆਂ ਇੰਡਸਟਰੀ ਜਿਹੜੀਆਂ ਹੈਗੀਆਂ ਇੱਥੇ ਬਹੁਤ ਹਨ ਲੋਕ ਪਰ ਜਿਹੜੇ ਹੈਗੇ ਹੈ ਪ੍ਰਾਈਵੇਟ ਨੌਕਰੀ ਨਿੱਜੀ ਨੌਕਰੀਆਂ ਦੀ ਜਾਣ ਦੀ ਬਜਾਏ ਸਰਕਾਰੀ ਨੌਕਰੀਆਂ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਗੌਰਮੈਂਟ ਨੌਕਰੀ ਦੇ ਵਿੱਚ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੇ ਹਨ ਪ੍ਰੰਤੂ ਮੋਹਾਲੀ ਦੇ ਵਿੱਚ ਇੰਡਸਟਰੀ ਜ਼ਿਆਦਾ ਹੋਣ ਕਰਕੇ ਲੋਕਾਂ ਨੂੰ ਰੁਜ਼ਗਾਰ ਤਾਂ ਮਿਲ ਹੀ ਰਿਹਾ ਹੈ ਪ੍ਰੰਤੂ ਸਰਕਾਰੀ ਨੌਕਰੀਆਂ ਵੀ ਬਹੁਤ ਘੱਟ ਹਨ ਜਿਸ ਦੇ ਮੁਕਾਬਲੇ ਲੋਕਾਂ ਨੂੰ ਪ੍ਰਾਈਵੇਟ ਨੌਕਰੀ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ ਪ੍ਰਾਈਵੇਟ ਵਿੱਚ ਜਿੰਨੀ ਉਹਨਾਂ ਦੀ ਕੁਆਲੀਫਿਕੇਸ਼ਨ ਹੁੰਦੀ ਹੈ ਉਹਨਾਂ ਨੂੰ ਉਸ ਦੇ ਮੁਤਾਬਿਕ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਮੁਤਾਬਿਕ ਉਹਨਾਂ ਨੂੰ ਉਹਨਾਂ ਦਾ ਜਿਹੜਾ ਹੈਗਾ ਬਣਦਾ ਤਨਖਾਹ ਹੈਗੀ ਹੈ ਉਹ ਨਹੀਂ ਦਿੱਤੀ ਜਾਂਦੀ ਇਸ ਕਰਕੇ ਜਿਹੜੀ ਹੈਗੀ ਹੈ ਲੋਕ ਜਿਹੜੇ ਹੈਗੇ ਹੈ ਸਰਕਾਰੀ ਨੌਕਰੀਆਂ ਨੂੰ ਤਰਜੀਹ ਦਿੰਦੇ ਹਨ